ਸਾਡੇ ਸਥਾਨ ਦੇ ਨੇੜੇ ਕਾਫੀ ਸੈਰ ਸਪਾਟੇ ਦੀਆਂ ਥਾਵਾਂ ਹਨ ਜਿਨ੍ਹਾਂ ਵਿੱਚੋਂ ਅੱਜ ਤੁਹਾਨੂੰ ਮੈਂ ਆਪਣੇ ਏਰੀਏ ਦੇ ਕੱਪੜਿਆਂ ਬਾਰੇ ਦੱਸਣ ਜਾ ਰਹੇ ਹਾਂ ਸਾਡੇ ਸਥਾਨ ਦੇ ਨੇੜੇ ਹੀ ਇੱਕ ਮਾਰਕੀਟ ਲੱਗਦੀ ਹੈ ਜਿੱਥੇ ਕਿ ਬਹੁਤ ਹੀ ਜਾਇਜ਼ ਰੇਟ 'ਤੇ ਕੱਪੜੇ ਮਿਲਦੇ ਹਨ ਅਤੇ ਇੱਥੇ ਕਈ ਪ੍ਰਕਾਰ ਦੇ ਅਤੇ ਕਈ ਕਿਸਮਾਂ ਦੇ ਕੱਪੜੇ ਮਿਲਦੇ ਹਨ ਜੋ ਕਿ ਠੰਡ ਗਰਮੀ ਦੇ ਹਿਸਾਬ ਨਾਲ ਵਧੀਆ ਕੁਆਲਿਟੀ ਦੇ ਹਨ ਅਤੇ ਇਹਨਾਂ ਦੀ ਉਮਰ ਵੀ ਬਹੁਤ ਹੀ ਵਧੀਆ ਹੈ ਕਿਉਂਕਿ ਇਹਨਾਂ ਦੇ ਪਾਉਣ ਨਾਲ ਬਹੁਤ ਹੀ ਜ਼ਿਆਦਾ ਆਰਾਮਦਾਇਕ ਮਹਿਸੂਸ ਹੁੰਦਾ ਹੈ ਇਹ ਕੱਪੜੇ ਬਹੁਤ ਹੀ ਅਲੱਗ ਅਲੱਗ ਪ੍ਰਕਾਰ ਵਿੱਚ ਹਨ ਅਤੇ ਵਧੇਰੇ ਸਾਰਥਕ ਹਨ ਅਤੇ ਲੰਮੇਰੀ ਸਮੇਂ ਤੱਕ ਚੱਲ ਸਕਦੇ ਹਨ